ਮੈਨੂੰ ਅਪ ਮੈਂ ਆਪਣੀ ਲਿਖਣ ਲਈ ਵਿਚਾਰ ਸਮਾਜ ਤੋਂ ਲੈਂਦੀ ਹਾਂ ਭਾਵਨਾਵਾਂ ਤੋਂ ਵੀ ਆ ਜਾਂਦੇ ਨੇ ਕਿਉਂਕਿ ਜਿਹੜਾ ਸਮਾਜ ਹੈ ਅੱਜ ਦੇ ਸਮਾਜ ਦੇ ਵਿੱਚ ਇੰਨੀਆਂ ਕੁਰੀਤੀਆਂ ਹੋ ਰਹੀਆਂ ਨੇ ਇਨ੍ਹਾਂ ਕੁਰੀਤੀਆਂ ਦੇ ਕਾਰਨ ਕੁਛ ਨਾ ਕੁਛ ਲਿਖਣ ਦਾ ਮੌਕਾ ਮਿਲਦਾ ਰਹਿੰਦਾ ਹੈ ਜਿਵੇਂ ਕਿ ਆਪਣਾ ਅੱਜ ਦਾ ਆਪਣਾ ਮੇਨ ਹੁੰਦਾ ਵਿਆਹ ਦਾ ਟੌਪਿਕ ਵਿਆਹ ਦਾ ਜਿਹੜਾ ਮੁੱਦਾ ਗਾ ਉਹ ਲੋਕਾਂ ਲਈ ਅੱਜ ਕ ਅੱਜ ਦੇ ਟਾਈਮ ਦੇ ਵਿੱਚ ਇੱਕ ਮਜ਼ਾਕ ਬਣਿਆ ਹੋਇਆ ਕਿਉਂਕਿ ਜਿਹੜੇ ਲੋਕ ਨੇ ਉਹ ਵਿਆਹ ਪਹਿਲਾਂ ਉਨ੍ਹਾਂ ਨੂੰ ਜ ਪਹਿਲਾਂ ਵਿਆਹ ਦੀ ਜਲਦਬਾਜ਼ੀ ਹੁੰਦੀ ਹੈ ਵੀ ਜਲਦੀ ਸਾਡਾ ਵਿਆਹ ਹੋ ਜਾਵੇ ਪਰ ਵਿਆਹ ਤੋਂ ਬਾਅਦ ਜਿਹੜਾ ਉਨ੍ਹਾਂ ਦਾ ਟਾਈਮ ਪੀਰੀਅਡ ਹੁੰਦਾ ਉਹ ਇੱਕ ਸਾਲ ਜਾਂ ਛੇ ਮਹੀਨੇ ਜਾਂ ਦੋ ਸਾਲ ਬਹੁਤ ਘੱਟ ਲੰਘਾਉਂਦੇ ਨੇ ਕਿਉਂਕਿ ਅੱਜ ਦੀ ਘੜੀ ਜਿਹੜੀ ਅੱਜ ਦੀ ਪੀੜ੍ਹੀ ਹੈ ਉਹਦੇ ਵਿੱਚ ਪੇਸ਼ੈਂਸ ਦੀ ਬਹੁਤ ਕਮੀ ਹੈ ਪੇਸ਼ੈਂਸ਼ ਦੀ ਕਮੀ ਹੋਣ ਦੇ ਬਾਵਜੂਦ ਉਹ ਇੱਕ ਦੂਸਰੇ ਦੇ ਬਰਦਾਸ਼ ਨਹੀਂ ਕਰਦੇ ਅਤੇ ਜਿਹੜੇ ਸਮਾਂ ਸੋਸਾਇਟੀ ਹੈ ਇਹ ਇਨ੍ਹਾਂ ਗੱਲਾਂ ਦੇ ਖਿਲਾਫ ਹੁੰਦੀ ਹੈ ਇਨ੍ਹਾਂ ਗੱਲਾਂ ਕਰਕੇ ਹੀ ਲੋਕ ਮੈਨੂੰ ਕੁਛ ਨਾ ਕੁਛ ਲਿਖਣ ਦਾ ਮੌਕਾ ਮਿਲਦਾ ਰਹਿੰਦਾ ਅਤੇ ਭਾਵਨਾਵਾਂ ਜਿਹੜੀਆਂ ਲੋਕ ਅੱਜ ਅੱਜ ਦੇ ਲੋਕਾਂ ਦੇ ਵਿੱਚ ਭਾਵਨਾਵਾਂ ਬਿਲਕੁਲ ਖਤਮ ਹੋ ਚੁੱਕੀਆਂ ਨੇ ਉਹ ਜਿਹੜੇ ਅੱਜ ਦੇ ਲੋਕ ਨੇ ਉਹ ਇੱਕ ਦੂਸਰੇ ਦੇ ਇਨ੍ਹਾਂ ਭਾਵਨਾਵਾਂ ਦੀ ਕਦਰ ਬਿਲਕੁਲ ਵੀ ਨਹੀਂ ਕਰਦੇ ਅਤੇ ਲੋਕਾਂ ਲਈ ਪੈਸਾ ਆਪਣੀਆਂ ਫੀਲਿੰਗਸ ਤੋਂ ਭਾਵਨਾਵਾਂ ਤੋਂ ਵੱਧ ਕੇ ਹੈ ਜੇਕਰ ਲੋਕਾਂ ਦੇ ਵਿੱਚ ਕੋਈ ਫੀਲਿੰਗ ਹੋਊ ਤਾਹੀਂਓ ਤਾਂ ਰਿਸ਼ਤੇ ਕਾਇਮ ਰਹਿਣਗੇ ਰਿਸ਼ਤੇ ਲੋਕ ਅੱਜ ਦੇ ਲੋਕ ਰਿਸ਼ਤਿਆਂ ਤੋਂ ਵੱਧ ਕੇ ਪੈਸੇ ਨੂੰ ਅਹਿਮੀਅਤ ਦਿੰਦੇ ਹਨ ਕਿਉਂਕਿ ਜਿਹੜਾ ਪੈਸਾ ਲੋਕ ਇਸ ਨੂੰ ਹੀ ਸਭ ਕੁਛ ਮੰਨਦੇ ਨੇ ਰਿਸ਼ਤੇ ਨਾਤੇ ਕੁਝ ਵੀ ਨਹੀਂ ਮੰਨਦੇ ਰਿਸ਼ਤੇ ਸਭ ਸਭ ਤੋਂ ਵੱਧ ਜ਼ਰੂਰੀ ਹੁੰਦੇ ਨੇ